ਸਤਿ ਸ਼੍ਰੀ ਅਕਾਲ ਸਰ ਹਾਂਜੀ ਹਾਂਜੀ ਆਰਟ ਦੇ ਵਿੱਚ ਮਿਊਜ਼ਿਕ ਅਤੇ ਡਾਂਸ ਦੀ ਟੀਚਰ ਹਾਂ ਮੈਂ ਹਾਂਜੀ ਓਕੇ ਸਿਕਸਤ ਕਲਾਸ ਦੇ ਪਵਨ ਦੇ ਫਾਦਰ ਜਿਵੇਂ ਆਪਣਾ ਕਵਾਂ ਮਿਊਜਿਕ ਵਗੈਰਾ ਦੇ ਵਿੱਚ ਤਾਂ ਉਹਦੀ ਕਾਫੀ ਵਧੀਆ ਆਵਾਜ਼ ਹੈ ਜਿਵੇਂ ਹੁਣ ਕਿ ਕਲਾਸਿਕਲ ਮਿਊਜਿਕ ਦੇ ਦਿਓ ਤਾਂ ਵੀ ਕੋਈ ਸੋਫਟ ਸੋਗ ਦੇ ਦਿਓ ਹਾਂਜੀ ਉਹਦੀ ਕੋਈ ਜਿਵੇਂ ਆਪਾਂ ਸੋਫਟ ਸਿੰਗਿੰਗ ਕਹਿ ਦਿੰਦੇ ਹਾਂ ਇਹਦੀ ਆਵਾਜ਼ ਬਹੁਤ ਵਧੀਆ ਉਹਦੇ ਵਿੱਚ ਇਹਦੇ ਡਾਂਸ ਦੀ ਗੱਲ ਕਰੀਏ ਅਤੇ ਉਹਦੇ ਵਿੱਚ ਵੈਸੇ ਸਾਰਾ ਬਹੁਤ ਅੱਛਾ ਕਰ ਰਿਹਾ ਬਟ ਡਾਂਸ ਦੇ ਵਿੱਚ ਥੋੜ੍ਹੀ ਜਿਹੀ ਪ੍ਰੈਕਟਿਸ ਦੀ ਹੋਰ ਜ਼ਰੂਰਤ ਹੈ ਕਿ ਜਿੰਨੀ ਪ੍ਰੈਕਟਿਸ ਕਰੇਗਾ ਪ੍ਰੈਕਟਿਸ ਦੇ ਨਾਲ ਥੋੜ੍ਹਾ ਜਿਹਾ ਹੋਰ ਹੋ ਜਾਏਗਾ ਜਿਵੇਂ ਇਹਨੇ ਕਿਹਾ ਸੀ ਕਿ ਇਹਨਾਂ ਦੇ ਸਕੂਲ ਸਾਡੇ ਸਕੂਲ ਦੇ ਵਿੱਚ ਹੀ ਕਿ ਇਹ ਭੰਗੜਾ ਪਰਫੋਰਮ ਕਰਨਾ ਚਾਹੁੰਦਾ ਅਨੁਅਲ ਫੰਸ਼ਨ ਡੇ 'ਤੇ ਹੁਣ ਇਹਦੀ ਭੰਗੜੇ ਦੀ ਪ੍ਰੈਕਟਿਸ ਹੀ ਚੱਲ ਰਹੀ ਹੈ ਵੈਸੇ ਇਹ ਭੰਗੜੇ 'ਚ ਬਹੁਤ ਵਧੀਆ ਬਟ ਤੁਸੀਂ ਘਰ ਵੀ ਇਹਦੀ ਥੋੜ੍ਹੀ ਜਿਹੀ ਪ੍ਰੈਕਟਿਸ ਕਰਵਾਇਆ ਕਰੋ ਕਿ ਜਿਹਦੇ ਨਾਲ ਇਹਦਾ ਜਿਹੜਾ ਐ ਹਾਂਜੀ ਜਿੰਨਾ ਟਾਈਮ ਇਹ ਹੋ ਸਕਦਾ ਜ਼ਿਆਦਾਤਰ ਤੁਸੀਂ ਥੋੜ੍ਹੀ ਜਿਹੀ ਉਹਦੀ ਹੈਲਪ ਕਰਿਆ ਕਰੋ ਜਾਂ ਇਹਦੇ ਮਦਰ ਕਿ ਜਿਵੇਂ ਜ਼ਿਆਦਾ ਨਹੀਂ ਦਸ ਪੰਦਰਾ ਮਿੰਟ ਕੋਈ ਵੀ ਸੌਂਗ ਲਗਾ ਦਿੱਤਾ ਜਾਂ ਇਹਨੂੰ ਪੁੱਛ ਲਿਆ ਕਿ ਤੁਹਾਨੂ ਕੀ ਸਿਖਾਇਆ ਅੱਜ ਕਲਾਸ ਦੇ ਵਿੱਚ ਕੀ ਸਿੱਖ ਕੇ ਆਇਆ ਅੱਜ ਨਵਾਂ ਤੂੰ ਭੰਗੜੇ ਦੇ ਕਿਹੜੇ ਸਟੈਪ ਸਿੱਖੇ ਹੈ ਉਹ ਸਾਨੂੰ ਕਰਕੇ ਦਿਖਾ ਹਾਂਜੀ ਬ ਅਨੁਅਲ ਫੰਕਸ਼ ਦੇ ਹੈ ਜੈਨ ਦੇ ਵਿੱਚ ਆਏਗਾ ਜਨਵਰੀ ਹਾਂਜੀ ਵੈਸੇ ਤਾਂ ਪਏ ਨੇ ਦਿਨ ਕਾਫੀ ਜਿਹਦੇ ਨਾਲ ਇਹਦੀ ਪ੍ਰੈਕਟਿਸ ਹੋਰ ਵਧੀਆ ਹੋ ਜਾਏਗੀ ਪ੍ਰੈਕਟਿਸ ਦੇ ਨਾਲ ਸਟੈਪਸ ਹੋਰ ਵਧੀਆ ਕਰਨ ਲੱਗ ਜਾਏਗਾ ਇਹ ਹਾਂਜੀ ਕਿ ਮਤਲਬ ਇੱਦਾਂ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਵੀਕ ਹੈ ਠੀਕ ਹੈ ਆਉਂਦਾ ਹੀ ਨਹੀਂ ਪਿਆ ਬਹੁਤ ਜਲਦੀ ਹਰ ਚੀਜ਼ ਨੂੰ ਗਰੈਬ ਕਰ ਲੈਂਦਾ ਜਲਦੀ ਸਿੱਖ ਜਾਂਦਾ ਜ਼ਿਆਦਾ ਹਾਂਜੀ ਜਿਵੇਂ ਕਈ ਬੱਚੇ ਹੁੰਦੇ ਨੇ ਕਿ ਜਿਵੇਂ ਕਈ ਬੱਚਿਆਂ ਤਾਂ ਇੱਦਾਂ ਨਾ ਵੀ ਇੱਕ ਚੀਜ਼ ਨੂੰ ਦਸ ਦਸ ਵਾਰੀ ਨਹੀਂ ਇਹਨੇ ਸਿਰਫ ਇੱਕ ਦੋ ਵਾਰੀ ਸਿਖਾਓ ਇਹ ਖੁਦ ਹੀ ਸਭ ਟਰਾਈ ਕਰਨ ਲੱਗ ਜਾਂਦਾ ਸਿੱਖ ਜਾਂਦਾ ਜਲਦੀ ਮਤਲਬ